ਇੱਕ ਪੰਜਾਬੀ ਬੰਦੇ ਲਈ ਕਿਸੇ ਦੂਜੇ ਬੰਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸੇ ਦੂਜੀ ਭਾਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ ਜਿਵੇਂ ਕਿ ਹਿੰਦੀ ਅੰਗਰੇਜ਼ੀ ਬਹੁਤ ਜ਼ਿਆਦਾ ਹਿੰਦੀ ਹਿੰਦੀ ਦੇ ਲੋਕ ਜਿਹੜੇ ਹਿੰਦੀ ਭਾਸ਼ਾ ਬੋਲਦੇ ਹਨ ਉਹ ਪੰਜਾਬੀ ਸਮਝ ਵੀ ਲੈਂਦੇ ਕਿਉਂਕਿ ਹਿੰਦੀ ਪੰਜਾਬੀ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਔਰ ਬਹੁਤ ਸਾਰੇ ਲੋਕ ਜੋ ਕਿ ਹਿੰਦੀ ਜਾਂ ਪੰਜਾਬੀ ਨਹੀਂ ਸਮਝ ਪਾਉਂਦੇ ਉਹਨਾਂ ਲਈ ਕਿਸੇ ਦੂਜੀ ਭਾਸ਼ਾ ਦਾ ਸਹਾਰਾ ਲੈਣਾ ਪੈਂਦਾ ਜਿਵੇਂ ਕਿ ਅੰਗਰੇਜ਼ੀ ਔਰ ਇੰਨੀ ਜ਼ਿਆਦਾ ਵਧੀਆ ਆਪਣੀ ਅੰਗਰੇਜ਼ੀ ਵੀ ਨਹੀਂ ਹੈ ਪੰਜਾਬੀ ਬੰਦਿਆਂ ਦੀ ਕਿ ਉਹ ਕਿਸੇ ਨਾਲ ਅੰਗਰੇਜ਼ੀ 'ਚ ਹੀ ਸਹੀ ਤਰੀਕੇ ਨਾਲ ਗੱਲ ਕਰ ਸਕਣ ਇਸ ਲਈ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਕਿਸੇ ਦੂਜੀ ਭਾਸ਼ਾ ਦੇ ਬ ਬੰਦੇ ਨਾਲ ਗੱਲ ਕਰਦਿਆਂ ਹੋਇਆ ਜਿਵੇਂ ਕਿ ਮੇਰੇ ਦੋਸਤ ਹੀ ਹੈ ਕੇਰਲਾ ਦੇ ਹੈ ਤਮਿਲਨਾਡੂ ਦੇ ਹੈ ਜਾਂ ਤਾਂ ਓ ਉੜੀਸਾ ਦੇ ਹੈ ਉਹਨਾਂ ਨੂੰ ਪੰਜਾਬੀ ਭਾਸ਼ਾ ਬੋਲਣ ਜਾਂ ਸਮਝਣ ਲਈ ਬਹੁਤ ਦਿੱਕਤ ਆਉਂਦੀ ਆ ਤਾਂ ਉਹਨਾਂ ਨਾਲ ਅੰਗਰੇਜ਼ੀ 'ਚ ਹੀ ਗੱਲਬਾ ਗੱਲਬਾਤ ਕਰਨੀ ਪੈਂਦੀ ਹੈ ਔਰ ਸਾਨੂੰ ਅੰਗਰੇਜ਼ੀ 'ਚ ਗੱਲਬਾਤ ਕਰਦਿਆਂ ਹੀ ਬਹੁਤ ਦਿੱਕਤ ਹੁੰਦੀ ਹੈ